ਸਾਡੇ ਪਿੰਡ ਦੇ ਬਾਹਰ ਹੀ ਜਾਨਵਰਾਂ ਦੀ ਮੰਡੀ ਲੱਗਦੀ ਹੈ ਤਾਂ ਉੱਥੇ ਕਈ ਤਰ੍ਹਾਂ ਦੇ ਜਾਨਵਰ ਵਿਕਦੇ ਹਨ ਤਾਂ ਮੈਂ ਉਸੇ ਮੰਡੀ ਵਿੱਚੋਂ ਜਾਨਵਰ ਖਰੀਦੇ ਹਨ ਮੇਰੇ ਕੋਲ ਗਾਵਾਂ ਵੀ ਹਨ ਕਈ ਤਰ੍ਹਾਂ ਦੀਆਂ ਮੱਝਾਂ ਵੀ ਹਨ ਅਤੇ ਬੱਕਰੀਆਂ ਵੀ ਹਨ ਤਾਂ ਮੈਂ ਉਹਨਾਂ ਦੀ ਸਾਂਭ ਸੰਭਾਲ ਦਾ ਧਿਆਨ ਆਪ ਰੱਖਦੀ ਹਾਂ ਟਾਈਮ ਸਿਰ ਉਹਨਾਂ ਨੂੰ ਚਾਰਾ ਪਾਣੀ ਸਭ ਕੁਛ ਖ਼ਾਸ ਧਿਆਨ ਰੱਖਦੀ ਹਾਂ ਤਾਂ ਜੋ ਟਾਈਮ ਨਾਲ ਉਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਤੰਦਰੁਸਤ ਰਹਿਣ ਉਹਨਾਂ ਦੀ ਕੀਮਤ ਪੰਜਾਹ ਹਜ਼ਾਰ ਤੋਂ ਵੱਧ ਹੀ ਹੈ ਅਤੇ ਉਹਨਾਂ ਦੀ ਦੇਖ ਰੇਖ ਕਰਕੇ ਮੈਂ ਆਪਣੀ ਕਮਾਈ ਦਾ ਸਾਧਨ ਵੀ ਬਣਾਇਆ ਹੋਇਆ ਹੈ ਮੈਂ ਦੁੱਧ ਵੇਚਦੀ ਹਾਂ ਅਤੇ ਦੁੱਧ ਵੇਚਦੀ ਹਾਂ ਅਤੇ ਬਾਹਰ ਭੇਜ ਕੇ ਉਤੋਂ ਕਰੀਮ ਕਢਵਾ ਕੇ ਵੀ ਕਮਾਈ ਕੀਤੀ ਜਾ ਸਕਦੀ ਹੈ ਮੈਂ ਉਸ ਤੋਂ ਚੰਗੀ ਕਮਾਈ ਕਰਦੀ ਹਾਂ